ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਅੱਛਾ ਠੀਕ ਹੈ ਹਾਂਜੀ ਕਿੱਥੋਂ ਠੀਕ ਹੈ ਹਮ ਹਾਂਜੀ ਦੱਸ ਸਕਦੇ ਹਾਂ ਜੀ ਹੈਗੀਆਂ ਤਾਂ ਵੈਸੇ ਕਿੰਨੀਆਂ ਹੀ ਆ ਪਰ ਵਿੱਚ ਵਿੱਚ ਮੇਨ ਵੀ ਹੈਗੀਆਂ ਜਿੱਥੇ ਜਿੱਥੇ ਸਾਨੂੰ ਜਾਣੀ ਕਿ ਜਾਣਾ ਚਾਹੀਦਾ ਨਾਲੇ ਦੇਖਣ ਨੂੰ ਵੀ ਵਧੀਆ ਆ ਅਤੇ ਮਾਹੌਲ ਵੀ ਵਧੀਆ ਆ ਦੇਖਣ ਨੂੰ ਤੁਸੀਂ ਘੁੰਮ ਫਿਰ ਵੀ ਸਕਦੇ ਆਂ ਮੱਥਾ ਵੀ ਟੇਕ ਸਕਦੇ ਆਂ ਫੈਮਲੀ ਨਾਲ ਵੀ ਜਾ ਸਕਦੇ ਆਂ ਜੇ ਤੁਸੀਂ ਇਕੱਲੇ ਜਾਣਾ ਚਾਹੁੰਦੇ ਤੁਸੀਂ ਇਕੱਲੇ ਵੀ ਜਾ ਸਕਦੇ ਆਂ ਨਾਲੇ ਤੁਹਾਡੇ ਬਜਟ ਵਿੱਚ ਵੀ ਹੁੰਦੀਆਂ ਉਹ ਜਗ੍ਹਾ ਅਤੇ ਹਾਂਜੀ ਖਾਣਾ ਪੀਣਾ ਵੀ ਐਨ ਵਧੀਆ ਨਾਮ ਉਹਨਾਂ ਦਾ ਹੈਗਾ ਆ ਹਮ ਹਮ ਨਾਮ ਤੁਸੀਂ ਹਰਿਮੰਦਰ ਸਾਹਿਬ ਵੀ ਜਾ ਸਕਦੇ ਆਂ ਗੋਲਡਨ ਟੈਂਪਲ ਜਿਹਨੂੰ ਕਹਿੰਦੇ ਆ ਜਲਿਆਂਵਾਲੇ ਬਾਗ ਵੀ ਜਾ ਸਕਦੇ ਆਂ ਤੁਸੀਂ ਅਤੇ ਆਉਂਦੀ ਵਾਰ ਤੁਸੀਂ ਨਵਾਂ ਸ਼ਹਿਰ ਭਗਤ ਸਿੰਘ ਦਾ ਘਰ ਵੀ ਦੇਖ ਸਕਦੇ ਆਂ ਉਹ ਵੀ ਬਹੁਤ ਪੁਰਾਣੀ ਜਗ੍ਹਾ ਨਾਲੇ ਵਧੀਆ ਜਗ੍ਹਾ ਬਣਾਈ ਹੋਈ ਆ ਉੱਥੇ ਮਿਊਜ਼ਅਮ ਵੀ ਹੈਗਾ ਆ ਭਗਤ ਸਿੰਘ ਦਾ ਉੱਥੇ ਪੁਰਾਣਾ ਸਮਾਨ ਵੀ ਰੱਖਿਆ ਹੋਇਆ ਉਹਨਾਂ ਦਾ ਜੋ ਉਹਨਾਂ ਦੇ ਟਾਈਮਾਂ ਵਿੱਚੋਂ ਵਰਤਦੇ ਸੀ ਜਾਂ ਯੂਜ਼ ਕਰਦੇ ਸੀ ਕਾਫੀ ਕੁਛ ਪਿਆ ਵਾ ਉਹਨਾਂ ਦਾ ਤੁਸੀਂ ਅਨੰਦਪੁਰ ਸਾਹਿਬ ਵੀ ਜਾ ਸਕਦੇ ਆਂ ਹਾਂਜੀ ਹਾਂਜੀ ਜਾਣੇ ਨੂੰ ਜੇ ਤੁਸੀਂ ਗੱਡੀ ਵਿੱਚ ਜਾਓਂਗੇ ਤਾਂ ਸਾਰਿਆਂ ਨਾਲ ਬੈਸਟ ਹੈ ਜਾਣੇ ਨੂੰ ਤਾਂ ਬੱਸਾਂ ਵੀ ਹੈਗੀਆਂ ਬੱਸੀ ਵਿੱਚ ਵੀ ਜਾ ਸਕਦੇ ਹਾਂ ਪਰ ਫਿਰ ਬੱਸ ਵਿੱਚ ਤੁਹਾਡਾ ਟਾਈਮਿੰਗ ਬਹੁਤ ਖਰਾਬ ਹੋਣੀ ਆ ਤਾਂ ਕਰਕੇ ਜੇ ਤੁਸੀਂ ਗੱਡੀ ਵਿੱਚ ਜਾਓਂਗੇ ਤਾਂ ਸਾਰਿਆਂ ਨਾਲੋਂ ਬੈਸਟ ਆ ਕਿਉਂਕਿ ਹੁਣ ਮੌਸਮ ਵੀ ਠੰਢਾ ਆ ਗੱਡੀ ਵਿੱਚ ਜਾਣ ਵਾਲਾ ਮੌਸਮ ਅਨੰਦਪੁਰ ਸਾਹਿਬ ਹੈਗਾ ਆ ਅਨੰਦਪੁਰ ਸਾਹਿਬ ਅਜੂਬਾ ਬਣਿਆ ਹੋਇਆ ਉੱਥੇ ਤੁਸੀਂ ਘੁੰਮ ਸਕਦੇ ਆ ਕੇਸਗੜ੍ਹ ਸਾਹਿਬ ਵੀ ਹੈਗਾ ਉੱਥੇ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਇਹ ਪੰਜਾਬ ਦੀਆਂ ਜਗ੍ਹਾ ਆ ਨਾਲੇ ਸਾਰਿਆਂ ਨਾਲ ਵਧੀਆ ਅਤੇ ਪਵਿੱਤਰ ਜਗ੍ਹਾ ਆ ਘੁੰਮ ਫਿਰ ਸਕਦੇ ਆ ਤੁਸੀਂ ਜਿੱਥੇ ਵੀ ਮਰਜ਼ੀ ਹਮ ਕੋਈ ਗੱਲ ਨਹੀਂ ਜ਼ਰੂਰ ਜੀ ਨਾ ਨਾ ਕੋਈ ਗੱਲ ਨਹੀਂ ਜ਼ਰੂਰ ਜੀ ਜ਼ਰੂਰ ਓਕੇ ਓਕੇ